ਬਾਈ ਪਿਛਲੇ ਇੱਕ ਸਾਲ ਦੇ ਵਿੱਚ ਜੇ ਗੱਲ ਕਰੀਏ ਤਾਂ ਯਾਦਗਾਰੀ ਘਟਨਾ ਸਾਡਾ ਅੰਬਰਸਰ ਦਾ ਟਰਿਪ ਹੈ ਜਿਹ 'ਚ ਬ ਬਾਹਲ਼ਾ ਹੀ ਨਜਾਰੇ ਆਏ ਤੇ ਜਿਹ 'ਚ ਸਭ ਤੇ ਮੇਨ ਬੰਦਾ ਤਾਂ ਸਾਡਾ ਪਾਲਾ ਦੂਏ ਨੰਬਰ 'ਤੇ ਨਾਮਾ ਤੀਆ ਦਾਸਤਾ ਬਾ ਇੱਕ ਤੇ ਇੱਕ ਟੱਕਰ ਗਏ ਅਤੇ ਬ ਰੰਗ ਬੰਨ ਰੱਖਿਆ ਪਤਾ ਹੀ ਨੀ ਲੱਗਿਆ ਕਦ ਸਾਡਾ ਟੂਰ ਮੁੱਕ ਗਿਆ